ਮੈਨੂੰ ਪੁਰਾਣੇ ਤਰੀਕਿਆਂ ਨਾਲ ਕੰਮ ਕਰਨਾ ਵਧੀਆ ਲੱਗਦਾ ਹੈ ਮੈਨੂੰ ਪੱਛਮੀ ਸੱਭਿਅਤਾ ਦਾ ਪਹਿਰਾਵਾ ਔਖਾ ਲੱਗਦਾ ਹੈ ਮੈਂ ਇੱਕ ਵਾਰੀ ਵੀ ਪਾ ਕੇ ਵੇਖਿਆ ਤਾਂ ਮੈਨੂੰ ਅੱਧਾ ਘੰਟਾ ਲੱਗ ਗਿਆ ਸੀ